ਸਾਡੀ ਰਸੋਈ ਵਿੱਚ ਅੱਜ ਕੱਲ੍ਹ ਬਹੁਤ ਸਹੂਲਤਾਂ ਹਨ ਤਾਂ ਕਿ ਪਹਿਲਾਂ ਉਹ ਪੁਰਾਣੇ ਜ਼ਮਾਨੇ ਵਿੱਚ ਕੋਈ ਵੀ ਇੱਦਾਂ ਦੀ ਸਹੂਲਤ ਨਹੀਂ ਹੁੰਦੀ ਸੀ ਚੁੱਲ੍ਹੇ 'ਤੇ ਰੋਟੀ ਬਣਾਉਣੀ ਸਟੋਪ ਵਗੈਰਾ ਹੁੰਦੇ ਸੀ ਪੁਰਾਣੇ ਜ਼ਮਾਨੇ ਵਿੱਚ ਕੋਈ ਗੈਸ ਨਹੀਂ ਹੁੰਦਾ ਸੀ ਹੁਣ ਅੱਜ ਕੱਲ੍ਹ ਦੇ ਨਵੇਂ ਜ਼ਮਾਨੇ ਵਿੱਚ ਗੈਸ ਮਿਕਸਚਰ ਸਿਲੰਡਰ ਸਾਰਾ ਕੁਛ ਆ ਗਿਆ ਹੈ ਓਵਨ ਵਗੈਰਾ ਹਰ ਇੱਕ ਚੀਜ਼ ਹੁੰਦੀ ਹੈ ਰਸੋਈ ਵਿੱਚ ਪੁਰਾਣੇ ਜ਼ਮਾਨੇ ਵਿੱਚ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਹੁੰਦੀ ਸੀ ਪੁਰਾਣੇ ਬਜ਼ੁਰਗ ਜੋ ਵੀ ਹੁੰਦੇ ਸੀ ਉਹ ਚੁੱਲ੍ਹੇ 'ਤੇ ਰੋਟੀ ਬਣਾਉਂਦੇ ਸੀ ਪਾਥੀਆਂ ਵਗੈਰਾ ਲਗਾ ਕੇ ਬਾਲਣ ਲਿਆ ਕੇ ਉਹਨਾਂ ਨੇ ਬਾਹਰੋਂ ਲਿਆਉਣਾ ਫਿਰ ਉਹਨਾਂ ਨੇ ਚੁੱਲ੍ਹੇ 'ਤੇ ਰੋਟੀ ਬਣਾਉਣੀ ਹਾਂ ਅੱਜ ਕੱਲ੍ਹ ਮੌਡਰਨ ਜ਼ਮਾਨਾ ਹੈ ਹਰ ਇੱਕ ਸਹੂਲਤ ਹੈ ਸਿਲੰਡਰ ਵੀ ਹੈ ਮਿਕਸਚਰ ਉਹ ਓਵਨ ਵਗੈਰਾ ਸਭ ਕੁਝ ਹੁੰਦਾ ਹੈ ਹਰ ਇੱਕ ਸਹੂਲਤ ਹੈ ਬਿਜਲੀ ਦੀ ਬਿਜਲੀ ਵੀ ਹੁੰਦੀ ਸੀ ਪਹਿਲਾਂ ਪਿਛਲੇ ਜ਼ਮਾਨੇ ਵਿੱਚ ਬਿਜਲੀ ਇੰਨੀ ਘੱਟ ਹੁੰਦੀ ਸੀ ਹੁਣ ਹਰ ਇੱਕ ਸਭ ਬਿਜਲੀ ਹੈ ਸਭ ਕੁਝ ਹੈ ਮਤਲਬ ਕਿ ਹਰ ਇੱਕ ਸਹੂਲਤ ਹੈ ਸਾਨੂੰ ਬਿਜਲੀ ਦੀ ਪਹਿਲੇ ਜ਼ਮਾਨੇ ਵਿੱਚ ਪੁਰਾਣੇ ਜ਼ਮਾਨੇ ਵਿੱਚ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਹੁੰਦੀ ਸੀ ਜਿਹੜੇ ਸਾਡੇ ਪੁਰਾਣੇ ਬਜ਼ੁਰਗਾਂ ਹਨ ਉਹਨਾਂ ਨੇ ਕਦੀ ਗੈਸ ਸਿਲੰਡਰ ਨਹੀਂ ਦੇਖਿਆ ਹੋਵਨ ਵੀ ਨਹੀਂ ਦੇਖਿਆ ਕੁਛ ਵੀ ਇੱਦਾਂ ਦਾ ਮਿਕਸਚਰ ਕੁਛ ਵੀ ਨਹੀਂ ਦੇਖਿਆ ਹੁਣ ਸਾਡੀ ਰਸੋਈ ਵਿੱਚ ਕੋਈ ਵੀ ਹਰ ਇੱਕ ਸਹੂਲਤ ਹੈ ਜੋ ਵੀ ਦੇਖੋਗੇ ਅੱਜ ਕੱਲ੍ਹ ਹਰ ਇੱਕ ਦੇ ਘਰ ਵਿੱਚ ਸਹੂਲਤ ਹੈ ਬਿਜਲੀ ਦੀ ਗੈਸ ਸਿਲੰਡਰ ਓਵਨ ਸਭ ਕੁਝ ਹੁੰਦਾ ਹੈ ਉਹ ਵੀ ਚਲਾਉਂਦੇ ਹੈ ਬਿਜਲੀ 'ਤੇ ਗੈਸ ਚੁੱਲ੍ਹੇ ਵੀ ਹੁੰਦੇ ਹੈ ਸਾਰਾ ਕੁਛ ਅੱਜ ਕੱਲ੍ਹ ਬਿਜਲੀ 'ਤੇ ਹੁੰਦਾ ਹੈ ਸਭ ਕੁਝ ਚੱਲਦਾ ਹੈ ਨਵੇਂ ਜ਼ਮਾਨੇ ਵਿੱਚ ਹੁਣ ਬੜੀ ਸਹੂਲਤ ਹੈ ਅੱਜ ਕੱਲ੍ਹ ਦੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਹਰ ਇੱਕ ਸਹੂਲਤ ਹੈ ਗੈਸ ਸਿਲੰਡਰ ਦੀ